ਭੰਗੜੇ ਦੇ ਕੱਪੜੇ ਪੰਜਾਬ ਦੇ ਜੀਵੰਤ ਖੇਤਰਾਂ ਤੋਂ ਆਉਂਦੇ ਹਨ ਇਸ ਦਾ ਮਤਲਬ ਹੈ ਕਿ ਕੱਪੜੇ ਸਿਰਫ ਦੇਖਣ ਵਿੱਚ ਹੀ ਨਹੀਂ ਚੰਗੇ ਲੱਗਦੇ ਹਨ ਸਗੋਂ ਉਰਜਾਵਾਨ ਨਾਚ ਲਈ ਕਾਫੀ ਆਰਾਮਦਾਇਕ ਅਤੇ ਮਜ਼ਬੂਤ ਹਨ ਮਰਦਾਂ ਮਰਦ ਭੰਗੜੇ ਲਈ ਆਮ ਤੌਰ 'ਤੇ ਕੁੜਤਾ ਚਾਦਰਾ ਅਤੇ ਨਾਲ ਤੁਰਲੇ ਵਾਲੀ ਪੱਗ ਪਹਿਨਦੇ ਹਨ ਜੋ ਉਹਨਾਂ ਦੇ ਸ਼ਕਤੀਸ਼ਾਲੀ ਨਾਚ ਦੇ ਅਨੁਕੂਲ ਹੁੰਦੇ ਹਨ ਭੰਗੜੇ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਨਿਯਮਾਂ ਕਿੰਨੇ ਮਹੱਤਵਪੂਰਨ ਹਨ ਜੋ ਇਸ ਨੂੰ ਸਿਰਫ ਇੱਕ ਨਾਚ ਤੋਂ ਵੱਧ ਬਣਾਉਂਦੇ ਹਨ ਭੰਗੜੇ ਦੀ ਪੋਸ਼ਾਕ ਅਦਾਕਾਰਾਂ ਨੂੰ ਇਹ ਪੋਸ਼ਾਕਾਂ ਦੇ ਰੰਗਾਂ ਕਰਕੇ ਹੋਰ ਵੀ ਜ਼ਿਆਦਾ ਆਕਰਸ਼ਕ ਬਣਾਉਂਦੇ ਹਨ ਇਹਨਾਂ ਦੇ ਰੰਗ ਲਾਲ ਪੀਲੇ ਹਰੇ ਨੀਲੇ ਆਕਰਸ਼ਕ ਹੁੰਦੇ ਹਨ ਲਾਲ ਰੰਗ ਉਰਜਾ ਅਤੇ ਜੀਵਨ ਬਾਰੇ ਹੈ ਇਹ ਭੰਗੜੇ ਦੇ ਜੀਵੰਤ ਕਦਮਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ਪੀਲੇ ਰੰਗ ਦੀ ਵਰਤੋਂ ਪੱਗਾਂ ਅਤੇ ਸਕਾਫਾਂ ਵਿੱਚ ਬਹੁਤ ਕੀਤੀ ਜਾਂਦੀ ਹੈ ਇਹ ਖੁਸ਼ੀ ਅਤੇ ਜਸ਼ਨ ਦਾ ਰੰਗ ਹੈ ਇਸ ਕਰਕੇ ਤੁਸੀਂ ਇਸ ਨੂੰ ਤਿਉਹਾਰਾਂ ਦੇ ਸਮਾਗਮਾਂ ਵਿੱਚ ਬਹੁਤ ਦੇਖਦੇ ਹੋ ਹਰਾ ਰੰਗ ਉਮੀਦ ਅਤੇ ਪੰਜਾਬ ਦੀ ਅਮੀਰੀ ਖੇਤੀ ਪਰੰਪਰਾ ਨੂੰ ਦਰਸਾਉਂਦਾ ਹੈ ਪੀਲਾ ਰੰਗ ਨਾਚ ਵਿੱਚ ਸ਼ਾਂਤੀ ਅਤੇ ਡੂੰਘੇ ਅਰਥ ਲਿਆਉਂਦਾ ਹੈ ਧੰਨਵਾਦ